ਮੈਂ ਬਾਸਕਿਟਬਾਲ ਸ਼ੂਜ ਓਡਰ ਕੀਤੇ ਸੀ ਵੈਜੰਤੀ ਦੇ ਜ ਜੋ ਕਿ ਮੈਨੂੰ ਮੇਰੇ ਟੀਚਰ ਨੇ ਕਿਹਾ ਸੀਗਾ ਕਿ ਹਾਂ ਬਹੁਤ ਵਧੀਆ ਹੁੰਦੇ ਆ ਤੂੰ ਲੈ ਇਸ ਕਰਕੇ ਮੈਂ ਓਡਰ ਕੀਤੇ ਸੀ ਹੁਣ ਮੈਂ ਇਹ ਮੇਰੇ ਕੋਲ ਪਹੁੰਚ ਚੁੱਕੇ ਨੇ ਜੋ ਕਿ ਬਹੁਤ ਵਧੀਆ ਨੇ ਇਹ ਮਤਲਬ ਕਿ ਕਾਫੀ ਅੱਛੇ ਹੈ ਥੱਲੇ ਤੋਂ ਇਹਦੀ ਗਰਿਪ ਵੀ ਬਹੁਤ ਅੱਛੀ ਹੈ ਇਸਦੇ ਨਾਲ ਜੰਪ ਵੀ ਮਤਲਬ ਕਿ ਕਾਫੀ ਲੈ ਹੋ ਜਾਂਦਾ ਏ ਔਰ ਸਪੀਡ ਦੇ ਵਿੱਚ ਵੀ ਕਾਫੀ ਹੈਲਪ ਮਿਲਦੀ ਹੈ ਔਰ ਇਹ ਕਲੀਨ ਵੀ ਹੋ ਜਾਂਦੇ ਹੈ ਇਹਦਾ ਪ੍ਰਾਈਜ਼ ਵੀ ਮੈਨੂੰ ਠੀਕ ਹੀ ਮਿਲਿਆ ਜ਼ਿਆਦਾ ਮਹਿੰਗਾ ਨਹੀਂ ਮਿਲਿਆ ਜਿੰਨਾਂ ਕੁ ਮੇਰੇ ਹਿਸਾਬ ਤੋਂ ਸਹੀ ਸੀਗਾ ਇਹ